ਛੇ ਜੂਨ ਦੋ ਹਜ਼ਾਰ ਚਾਰ ਤੇਈ ਜਨਵਰੀ ਦੋ ਹਜ਼ਾਰ ਛੇ ਸਤਾਰ੍ਹਾਂ ਜੁਲਾਈ ਉੱਨ੍ਹੀ ਸੌ ਸਤਾਰ੍ਹਾਂ ਇੱਕੀ ਦਸੰਬਰ ਦੋ ਹਜ਼ਾਰ ਇੱਕ ਇੱਕ ਜੂਨ ਦੋ ਹਜ਼ਾਰ ਪੰਜ